ਸਾਡੇ ਸਤੂਲ ਵਿੱਚ ਇੱਕ ਪਹਿਲਾਂ ਡਰੈਂਦ ਛੇਵੀਂ ਤਲਾਸ ਵਿੱਚ ਜਦੋਂ ਅਸੀਂ ਛੋਟੇ ਛੋਟੇ ਪੜ੍ਹਦੇ ਹੁੰਦੇ ਸੀ ਉਸ ਸਮੇਂ ਇੱਕ ਟੀਚਰ ਡਰੈਂਗ ਪੇਟਿੰਨ ਦਾ ਹੁੰਦਾ ਸੀ ਉਹਦਾਂ ਨਾਂ ਸੀ ਤਬੰਤ ਰਾਏ ਜੋ ਕਿ ਬਹੁਤ ਜ਼ਿਆਦਾ ਪ੍ਰਸਿੱਧ ਕਲਾਕਾਰ ਸੀ ਉਹਦੀ ਪੇਟਿੰਨ ਇੰਨੀ ਤੇਜ਼ ਸੀ ਕਿ ਉਹ ਮਿੰਟ ਦੇ ਵਿੱਚ ਕੋਈ ਵੀ ਚੀਜ਼ ਜਿਵੇਂ ਸ ਸਮੁੰਦਰ ਤੋਂ ਲੈ ਕੇ ਉਹਦੇ ਵਿੱਚ ਜਹਾਜ਼ ਬਣਾਉਣਾ ਹੋਰ ਚੀਜ਼ਾਂ ਕੋਈ ਵੀ ਜਿਹੜੀ ਬੰਦੇ ਦੀ ਸਤਰ ਉਹ ਮਿੰਟ ਦੇ ਵਿੱਚ ਹੀ ਤਿਆਰ ਕਰਕੇ ਪੇਸ਼ ਕਰ ਦਿੰਦਾਂ ਸੀ ਉਸ ਉਸ ਦੀ ਤਲਾਸ਼ ਹੋਣ ਦੀ ਤਰੀਤਾ ਬਹੁਤ ਹੀ ਜ਼ਿਆਦਾ ਅਹਿਮੀਅਤ ਰੱਖਦਾ ਸੀ ਉਹ ਪਿਆਰ ਨਾਲ ਬੱਚਿਆਂ ਨੂੰ ਸਮਝਾਉਂਦਾ ਅਤੇ ਪਿਆਰ ਨਾਲ ਬੱਚਿਆਂ ਨੂੰ ਸਮਝਾਉਂਦਾ ਸੀ ਜਿਸ ਨਾਲ ਬੱਚਿਆਂ ਦੀ ਬੱਚਿਆਂ ਦੇ ਦਿਮਾਗ ਦੀ ਸ਼ਕਤੀ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਸੀ ਉਸ ਨੂੰ ਮੈਥ ਦੇ ਮੈਥ ਦੇ ਫਾਰਮੂਲਿਆਂ ਨਾਲ ਵੀ ਉਹ ਡਰੈਂਨ ਦੇ ਰੂਪ ਵਿੱਚ ਹੀ ਪੇਸ਼ ਤਰ ਦਿੰਦਾ ਸੀ ਤਾਂ ਬੱਚੇ ਨੂੰ ਉਸਦੀ ਕਲਾ ਸਿੱਖਣ ਵਿੱਚ ਬਹੁਤ ਜ਼ਿਆਦਾ ਲੋੜ ਹੁੰਦੀ ਸੀ ਪੇਟਿੰਨ ਵਿੱਚ ਪੇਟਿੰਨ ਨਾਲ ਬਹੁਤ ਜ਼ਿਆਦਾ ਬੱਚੇ ਨੂੰ ਚੰਗਾ ਗਿਆਨ ਪ੍ਰਾਪਤ ਹੁੰਦਾ ਹੈ